ਪੰਜਾਬੀ ਭਾਸ਼ਾ ਬਾਰੇ ਆਮ ਲੋਕਾਂ ਦੀ ਬਹੁਤ ਗਲਤ ਧਾਰਨਾਵਾਂ ਹੈ ਜਿਹੜਾ ਵਿਅਕਤੀ ਪੰਜਾਬੀ ਬੋਲਦਾ ਹੈ ਉਸ ਨੂੰ ਗਵਾਰ ਦੱਸਿਆ ਜਾਂਦਾ ਹੈ ਆਪਣੀ ਸਟੇਟਸ ਨੂੰ ਦਿਖਾਉਣ ਲਈ ਲੋਕ ਅੰਗਰੇਜ਼ੀ ਜਾਂ ਹਿੰਦੀ ਭਾਸ਼ਾ ਦੀ ਵਰਤੋਂ ਕਰਦੇ ਹਨ ਜੋ ਕਿ ਬਿਲਕੁਲ ਗਲਤ ਹੈ ਜੇਕਰ ਕੋਈ ਵਿਅਕਤੀ ਪੰਜਾਬੀ ਬੋਲਦਾ ਹੈ ਤਾਂ ਇਹ ਮੰਨਿਆ ਜਾਂਦਾ ਹੈ ਕਿ ਉਸਨੂੰ ਕੁਝ ਨਹੀਂ ਪਤਾ ਅਤੇ ਉਸਨੂੰ ਕੁਝ ਨਹੀਂ ਆਉਂਦਾ ਜੋ ਕਿ ਬਿਲਕੁਲ ਗਲਤ ਧਾਰਨਾ ਹੈ ਅੱਜ ਦੇ ਟਾਈਮ 'ਚ ਪੰਜਾਬੀ ਇਕਲੌਤੀ ਇਹ ਜਿਹੀ ਭਾਸ਼ਾ ਹੈ ਜਿਹੜੀ ਕਿ ਪੰਜਾਬੀਆਂ ਦੁਆਰਾ ਪੂਰੀ ਦੁਨੀਆ ਵਿੱਚ ਫੈਲਾ ਦਿੱਤੀ ਗਈ ਹੈ ਅਤੇ ਪੰਜਾਬੀ ਇੱਕ ਪਹਿਲੀ ਇਹੋ ਜਿਹੀ ਭਾਸ਼ਾ ਹੈ ਜਿਸ ਨੂੰ ਕਿ ਪੂਰੇ ਇੰਟਰਨੈਸ਼ਨਲ ਲੋਕ ਵੀ ਬੋਲਦੇ ਹਨ ਅਤੇ ਸ਼੍ਰੀ ਮੁੱਖ ਮੰਤਰੀ ਸਾਡੇ ਭ ਭਗਵੰਤ ਸਿੰਘ ਮਾਨ ਨੇ ਬਹੁਤ ਵਧੀਆ ਸ਼ਲਾਘਾ ਯੋਗ ਇੱਕ ਕੰਮ ਕੀਤਾ ਹੈ ਕਿ ਉਹਨਾਂ ਨੇ ਪੰਜਾਬੀ ਭਾਸ਼ਾ ਨੂੰ ਹਰ ਸਕੂਲ ਵਿੱਚ ਲਾਜ਼ਮੀ ਕਰ ਦਿੱਤਾ ਗਿਆ ਹੈ ਜਿਸ ਨਾਲ ਕਿ ਸਾਡੀ ਪੰਜਾਬੀ ਭਾਸ਼ਾ ਅੱਗੇ ਦਿਨ ਦੁੱਗਣੀ ਅਤੇ ਰਾਤ ਚੌਗਣੀ ਤਰੱਕੀ ਕਰੇਗੀ ਇਸ ਵਿੱਚ ਜੇਕਰ ਇਸਦਾ ਹੱਲ ਦੇਖਿਆ ਜਾਵੇ ਤਾਂ ਇਸਦਾ ਹੱਲ ਸਾਨੂੰ ਘਰ ਤੋਂ ਹੀ ਲੱਭਦਾ ਹੈ ਅੱਜ ਕੱਲ੍ਹ ਸਾ ਮਾਵਾਂ ਵੀ ਆਪਣੇ ਬੱਚਿਆਂ ਨੂੰ ਕਹਿੰਦੀਆਂ ਹਨ ਕਿ ਤੁਸੀਂ ਇੰਗਲਿਸ਼ ਵਿੱਚ ਗੱਲ ਕਰੋ ਨਾ ਕਿ ਪੰਜਾਬੀ ਵਿੱਚ ਜੋ ਕਿ ਬਿਲਕੁਲ ਗਲਤ ਹੈ ਸਾਨੂੰ ਪੰਜਾਬੀ ਨੂੰ ਵੀ ਓਨੀ ਹੀ ਤਵੱਜੋ ਦੇਣੀ ਚਾਹੀਦੀ ਹੈ ਜਿੰਨੀ ਕਿ ਅਸੀਂ ਬਾਕੀ ਹੋਰ ਭਾਸ਼ਾਵਾਂ ਨੂੰ ਦਿੰਦੇ ਹਨ ਇਸ ਦੀ ਸ਼ੁਰੂਆਤ ਸਾਨੂੰ ਆਪਣੇ ਘਰ ਤੋਂ ਕਰਨੀ ਚਾਹੀਦੀ ਹੈ ਸਾਨੂੰ ਕਦੇ ਵੀ ਪੰਜਾਬੀ ਬੋਲਣ ਵਿੱਚ ਸ਼ਰਮ ਨਹੀਂ ਮੰਨਣੀ ਚਾਹੀਦੀ ਸਗੋਂ ਜਦ ਵੀ ਕੋਈ ਸਾਡੇ ਪਿੰਡ ਵਿੱਚ ਜਾਂ ਲਾਗ ਪਾਸ ਕੋਈ ਭਈਆ ਹੁੰਦਾ ਹੈ ਅਸੀਂ ਉਹਦੇ ਨਾਲ਼ ਵੀ ਹਿੰਦੀ ਵਿੱਚ ਗੱਲ ਕਰਨ ਲੱਗ ਜਾਂਦੇ ਹਾਂ ਜਦਕਿ ਸਾਨੂੰ ਉਹਦੇ ਨਾਲ ਪੰਜਾਬੀ ਵਿੱਚ ਗੱਲ ਕਰਨੀ ਚਾਹੀਦੀ ਹੈ ਉਹ ਕਦੇ ਵੀ ਆਪਣੀ ਭਾਸ਼ਾ ਨੂੰ ਨਹੀਂ ਛੱਡਦਾ ਜਿਹੜਾ ਆਪਣੀ ਮਾਂ ਬੋਲੀ ਨੂੰ ਭੁੱਲ ਜਾਂਦਾ ਹੈ ਉਸਨੂੰ ਸਾਰੀ ਦੁਨੀਆ ਭੁੱਲ ਜਾਂਦੀ ਹੈ